ਪ੍ਰਾਰਥਨਾਵਾਂ ਅਤੇ ਉਪਾਸਨਾ ਬਾਰੇ ਅਸੀਂ ਕਈ ਵਾਰ ਬਹੁਤ ਜਿਹੜੀਆਂ ਗੱਲਾਂ ਵਾ ਜਿਹੜੇ ਕਿ ਝੂਠ ਬੋਲਦੇ ਹਾਂ ਜਿਵੇਂ ਕਿ ਅਸੀਂ ਰਾਤ ਨੂੰ ਸੋਚ ਲੈਂਦੇ ਹਾਂ ਸਵੇਰੇ ਉੱਠ ਕੇ ਪਾਠ ਕਰਾਂਗੇ ਪ੍ਰਾਰਥਨਾ ਕਰਾਂਗੇ ਪਰ ਫੇਰ ਸਾਡਾ ਜਿਹੜਾ ਮਨ ਇਨਾ ਉਹ ਸਵੇਰੇ ਬਦਲ ਜਾਂਦਾ ਏ ਇਸ ਲਈ ਫੇਰ ਝੂਠੇ ਪੈ ਜਾਂਦੇ ਇਨਾ ਆਪਣੇ ਆਪ ਚ ਈ ਇਨਾ ਅਤੇ ਕਈ ਵਾਰ ਅਸੀਂ ਕਹਿ ਦਿੰਦੇ ਗੁਰਦੁਆਰਾ ਸਾਹਿਬ ਜਾਵਾਂਗੇ ਪਰ ਫਿਰ ਨਹੀਂ ਜਾਇਆ ਜਾਂਦਾ ਜਿਵੇਂ ਕਈ ਵਾਰ ਫਿਰ ਇਸ ਤਰ੍ਹਾਂ ਹੁੰਦਾ ਵਾ ਕਿ ਹੋਰ ਕੰਮਾਂ ਕਾਰਾਂ ਲਈ ਜੇ ਟਾਈਮ ਨਿਕਲ ਜਾਂਦਾ ਪਰ ਪ੍ਰਾਰਥਨਾਵਾਂ ਕਰਨ ਲਈ ਇਨਾ ਪਾਠ ਕਰਨ ਲਈ ਸਾਡੇ ਕੋਲ ਟਾਈਮ ਨਹੀਂ ਨਿਕਲਦਾ ਉਹ ਇੱਕ ਸਾਡੀ ਅਣਗਹਿਲੀ ਵੀ ਆ ਅਤੇ ਅਣਗਹਿਲੀ ਦੇ ਕਾਰਨ ਵੀ ਇਹ ਸਭ ਸਾਨੂੰ ਆਪਣੇ ਆਪ ਨੂੰ ਝੂਠ ਜਾਂ ਕਿਸ ਤਰ੍ਹਾਂ ਵੀ ਆ ਕਰਨਾ ਪੈਂਦਾ ਬੋਲਣਾ ਪੈਂਦਾ ਇਨਾ ਪਰ ਸਾਨੂੰ ਇਹ ਜਿਹੜੀ ਚੀਜ਼ਾਂ ਵਾ ਇਹ ਬਾਅਦ ਵਿੱਚ ਮਹਿਸੂਸ ਜਿਹੜਾ ਉਹ ਅਸੀਂ ਚੰਗੀ ਤਰ੍ਹਾਂ ਚੰਗਾ ਮਹਿਸੂਸ ਨਹੀਂ ਕਰਦੇ ਸਾਨੂੰ ਅੰਦਰੇ ਅੰਦਰ ਸ਼ਰਮਿੰਦਗੀ ਵੀ ਹੁੰਦੀ ਆ ਵੀ ਅਸੀਂ ਇਹ ਸਵੇਰੇ ਉੱਠ ਕੇ ਪਾਠ ਕਿਉਂ ਨਹੀਂ ਕਰਦੇ ਅਸੀਂ ਹੁਣ ਆਪਣੇ ਗੁਰੂ ਮਹਾਰਾਜ ਅੱਗੇ ਪ੍ਰਾਰਥਨਾ ਕਿਉਂ ਨਹੀਂ ਕਰਦੇ ਇਨਾ ਸਾਨੂੰ ਚੰਗਾ ਮਹਿਸੂਸ ਵੀ ਨਹੀਂ ਹੁੰਦਾ ਇਨਾ ਪਰ ਇਹ ਜਿਹੜੀ ਆ ਇਸ ਤਰ੍ਹਾਂ ਹੀ ਆਪਣੀ ਰੂਟੀਨ ਬਣਾ ਲੈਂਦੇ ਪਰ ਜੇ ਰੂਟੀਨ ਬਣਾਈ ਜਾਵੇ ਵੀ ਅਸੀਂ ਸਵੇਰ ਉੱਠਣਾ ਹੈ ਪਾਠ ਕਰਨਾ ਹੈ ਇਹ ਬਹੁਤ ਵਧੀਆ ਗੱਲ ਹੈ ਆ ਪਰ ਜਿਵੇਂ ਅਸੀਂ ਆਪਣੇ ਆਪ ਨੂੰ ਕਹਿ ਦਿੰ ਦੇ ਸਵੇਰੇ ਉੱਠਾਂਗੇ ਪਾਠ ਕਰਾਂਗੇ ਗੁਰਦੁਆਰਾ ਸਾਹਿਬ ਜਾਵਾਂਗੇ ਪਰ ਜਾਇਆ ਨਹੀਂ ਜਾਂਦਾ ਇਸ ਲਈ ਸਾਨੂੰ ਜਦੋਂ ਇਹ ਕੰਮ ਨਹੀਂ ਕਰਦੇ ਤਾਂ ਮਹਿਸੂਸ ਵੀ ਸਾਨੂੰ ਬਹੁਤ ਜਿਹੜਾ ਮਾੜਾ ਮਹਿਸੂਸ ਹੁੰਦਾ ਐਨਾ